ਸਟੈਂਪ ਸਿੱਕੇ ਜਿਹੜੇ ਨੇ ਉਹ ਪੁਰਾਣੇ ਸਮਿਆਂ ਦੇ ਸਿੱਕੇ ਅਸੀਂ ਬਹੁਤ ਇਕੱਠੇ ਕੀਤੇ ਨੇ ਮੇਰੇ ਫਾਦਰ ਸਾਹਿਬ ਨੂੰ ਬੜਾ ਸ਼ੌਂਕ ਸੀ ਪੁਰਾਣੇ ਸਿੱਕਿਆਂ ਨੂੰ ਇਕੱਠੇ ਕਰਨ ਦਾ ਅਤੇ ਸਾਡੀ ਆਪਣੀ ਇੱਕ ਸ਼ੋਪ ਸੀ ਜਿਹਦੇ ਵਿੱਚ ਸਟੂ਼ਡੈਂਟ ਜਾਂ ਬੱਚੇ ਛੋਟੇ ਕੁਝ ਵੀ ਸਮਾਨ ਖਰੀਦਣ ਆਉਂਦੇ ਸੀ ਤਾਂ ਉਹ ਸਟੈਂਪ ਸਿੱਕੇ ਲਿਆਉਂਦੇ ਸੀ ਪੁਰਾਣੇ ਅਤੇ ਫਾਦਰ ਸਾਹਿਬ ਕਿਉਂਕਿ ਉਹ ਅੱਗੇ ਚੱਲਦੇ ਨਹੀਂ ਹੈਗੇ ਅਤੇ ਫਾਦਰ ਸਾਹਿਬ ਉਹਨਾਂ ਨੂੰ ਸੰਭਾਲ ਕੇ ਰੱਖਦੇ ਸੀ ਮੇਰੇ ਕੋਲ ਕਾਫੀ ਮਾਤਰਾ ਦੇ ਵਿੱਚ ਉਹ ਘਰ ਪਏ ਨੇ ਸਿੱਕੇ ਜਿਹਦੇ ਉਹਨਾਂ ਦੀ ਜਿਹੜਾ ਹੈ ਉਹ ਉਰਦੂ ਦੇ ਵਿੱਚ ਹੋਣ ਕਾਰਨ ਅਸੀਂ ਉਹ ਪੜ੍ਹ ਵੀ ਲੈਂਦੇ ਹਾਂ ਕਿ ਓਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਜਿਹੜੇ ਪੁਰਾਣੇ ਪੰਜਾਬ ਦੇ ਵਿੱਚ ਸਿੱਕੇ ਚੱਲਦੇ ਸੀ ਜਾਂ ਭਾਰਤ ਦੇ ਵਿੱਚ ਚੱਲਦੇ ਸੀ ਉਹ ਕਾਫੀ ਮਾਤਰਾ ਦੇ ਵਿੱਚ ਮੇਰੇ ਕੋਲ ਪਏ ਨੇ ਅਤੇ ਕਈਆਂ ਦੇ ਵਿੱਚ ਪੜ੍ਹਿਆ ਵੀ ਜਾਂਦਾ ਏ ਕਈਆਂ ਦੇ ਨਹੀਂ ਵੀ ਪੜ੍ਹਿਆ ਜਾਂਦਾ ਅਤੇ ਸ ਉਹਦੇ ਵਿੱਚੋਂ ਸਾਨੂੰ ਪਤਾ ਲੱਗਦਾ ਕਿ ਕਿਹੜੇ ਬਾਦਸ਼ਾਹ ਦੇ ਜਾਂ ਕਿਹੜੇ ਨਵਾਬ ਦੇ ਸਮੇਂ ਵਿੱਚ ਕਿਹੜਾ ਸਿੱਕਾ ਚੱਲਦਾ ਸੀ ਉਹ ਤੋਂ ਇਤਿਹਾਸ ਦੀ ਨੌਲੇਜ ਵਧੀਆ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਸਟੂ਼ਡੈਂਟ ਵੀ ਮੇਰੇ ਕੋਲ ਆਉਂਦੇ ਰਹਿੰਦੇ ਨੇ ਪੁਰਾਣੇ ਸਿੱਕੇ ਲੈ ਕੇ ਆਉਂਦੇ ਨੇ ਤੋ ਮੈਂ ਮੈਂ ਉਹਨਾਂ ਨੂੰ ਪੜ੍ਹ ਕੇ ਦੱਸਦਾ ਕਿ ਇਹ ਕਿਹੜੇ ਨਵਾਬ ਦੇ ਜਾਂ ਕਿਹੜੇ ਰਾਜੇ ਦੇ ਸਮੇਂ ਦੇ ਵਿੱਚ ਇਹ ਸਿੱਕੇ ਚੱਲਦੇ ਸੀ ਤਾਂ ਇਹਦੇ ਨਾਲ ਸਾਨੂੰ ਆਪਣੇ ਪਿੱਛੇ ਪਿਛੋਕੜ ਇਤਿਹਾਸ ਦੀ ਨੌਲੇਜ ਹੁੰਦੀ ਹੈ